ਮੈਂ ਅਗਰ ਗੱਲ ਕੀਤੀ ਜਾਵੇ ਆਪਣੇ ਇਲਾਕੇ ਦੇ ਵਿੱਚ ਅਸ਼ੋਕ ਬਾਂਠ ਨੂੰ ਜਾਣਦਾ ਹਾਂ ਉਹ ਇੱਕ ਸਿਆਸੀ ਲੀਡਰ ਹਨ ਉਹ ਐਨੇ ਵਧੀਆ ਬੰਦੇ ਹਨ ਐਨੇ ਵਧੀਆ ਪਰਸਨ ਹਨ ਕਿ ਮੈਨੂੰ ਕਦੇ ਵੀ ਫਿਊਚਰ ਦੇ ਵਿੱਚ ਜਾਂ ਪਿੱਛੇ ਕਦੇ ਵੀ ਲਾਈਫ 'ਚ ਉਹਨਾਂ ਦੀ ਲੋੜ ਪਈ ਤਾਂ ਉਹ ਮੇਰੇ ਨਾਲ਼ ਬਰਾਬਰ ਖੜ੍ਹੇ ਹਨ ਇੱਕ ਉਹਨਾਂ ਨੇ ਵੱਡੇ ਭਰਾ ਵਾਂਗੂੰ ਮੇਰੀ ਮਦਦ ਕੀਤੀ ਹੈ ਜਿਸ ਵਿੱਚ ਮੈਂ ਕਦੇ ਵੀ ਰਾਹ ਭਟਕਿਆ ਹਾਂ ਤਾਂ ਉਹਨਾਂ ਨੇ ਮੈਨੂੰ ਸਹੀ ਦਿਸ਼ਾ ਦਿਖਾਈ ਹੈ ਉਹ ਸਿਆਸੀ ਪਾਰਟੀ ਨਾਲ਼ ਬਿਲੋਂਗ ਕਰਦੇ ਹਨ